ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਲੁਧਿਆਣਾ ਤੋਂ ਗੁਰਮੁਖ ਸਿੰਘ ਗੱਲ ਕਰ ਰਿਹਾ ਜੀ ਵਧੀਆ ਸਰ ਮੈਂ ਨਾ ਤੁਹਾਡੀ ਇੱਕ ਵੀਡੀਓ ਦੇਖੀ ਸੀ ਸਰ ਤੁਸੀਂ ਗਰਪਬਲੀ ਪਿੰਡ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਤੁਸੀਂ ਨਾ ਤੁਸੀਂ ਗੁੜ ਬਣਾਉਂਦੇ ਹੋ ਸਰ ਤੁਹਾਡਾ ਗੁੜ ਦਾ ਕੰਮ ਆ ਜੀ ਠੀਕ ਹੈ ਸਰ ਸਾਨੂੰ ਨਾ ਗੁੜ ਦੀ ਲੋੜ ਸੀਗੀ ਔਰਗੈਨਿਕ ਗੁੜ ਦੀ ਲੋੜ ਹਾਂਜੀ ਸਰ ਅੱਛਾ ਅੱਛਾ ਠੀਕ ਹੈ ਸਰ ਅਤੇ ਸਰ ਤੁਸੀਂ ਗੁੜ ਦੀ ਹੋਮ ਡਿਲੀਵਰੀ ਕਰ ਦਿੰਦੇ ਹੋ ਜਾਂ ਤੁਹਾਡੇ ਕੋਲ ਆਉਣਾ ਪਏਗਾ ਸਾਨੂੰ ਲੈਣ ਅੱਛਾ ਠੀਕ ਹੈ ਸਰ ਤੁਸੀਂ ਰਿਕੁਾਇਰਮੈਂਟ ਦੇ ਹਿਸਾਬ ਨਾਲ ਬਣਾ ਵੀ ਦਿੰਦੇ ਹੋ ਸਾਨੂੰ ਸਰ ਦਸ ਕਿਲੋ ਗੁੜ ਦੀ ਲੋੜ ਸੀਗੀ ਨਹੀਂ ਸਰ ਦਸ ਕਿਲੋ ਲੈਣਾ ਹੀ ਪਹਿਲਾਂ ਜਿੱਦਾਂ ਸਾਨੂੰ ਵਧੀਆ ਲੱਗੇਗਾ ਹਾਂਜੀ ਹਾਂਜੀ ਜੇ ਗੁੜ ਸਾਨੂੰ ਤੁਹਾਡਾ ਚੰਗਾ ਲੱਗਿਆ ਅਸੀਂ ਹੋਰ ਵੀ ਲਵਾਂਗੇ ਜੀ ਸਰ ਗੁੜ ਦਾ ਪਰਾਈਜ਼ ਕੀ ਹੈ ਸਰ ਅੱਛਾ ਤੁਹਾਡੇ ਕੋਲ ਤੁਹਾਡਾ ਸਰ ਲੋਕੇਸ਼ਨ ਕੀ ਆ ਹਾਂਜੀ ਸਾਨੂੰ ਲੋਕੇਸ਼ਨ ਆਪਣੀ ਸੈਂਡ ਕਰ ਦਿਓ ਅਸੀਂ ਤੁਹਾਡੇ ਕੋਲ ਵਿਜਿਟ ਕਰਾਂਗੇ ਕੱਲ੍ਹ ਕੱਲ੍ਹ ਆਵਾਂਗੇ ਸਰ ਮੋਰਨਿੰਗ ਟਾਈਮ ਆ ਜਾਵਾਂ ਸਰ ਦਸ ਕੁ ਵਜੇ ਹਾਂਜੀ ਹਾਂਜੀ ਠੀਕ ਹੈ ਸਰ ਸਰ ਤਾਜ਼ਾ ਗੁੜ ਵੀ ਮਿਲ ਜੂਗਾ ਆਪਾਂ ਨੂੰ ਹਾਂਜੀ ਹਾਂਜੀ ਓਕੇ ਸਰ ਸਾਨੂੰ ਤਾਜ਼ਾ ਗੁੜ ਵੀ ਸਰ ਖੁਦ ਬਣਾ ਕੇ ਦਿਓ ਕੁਛ ਸਾਨੂੰ ਚਾਹੀਦਾ ਗਰਮ ਗੁੜ ਠੀਕ ਹੈ ਸਰ ਕੱਲ੍ਹ ਅਸੀਂ ਨਾ ਨੌਂ ਵਜੇ ਵਿਜ਼ਿਟ ਕਰਾਂਗੇ ਹਾਂਜੀ ਸਰ ਉਹ ਤੇਲ ਵੀ ਅਸੀਂ ਲੈਣਾ ਵਾ ਉਹ ਵੀ ਲੈ ਲਵਾਂਗੇ ਅਤੇ ਉਹ ਸਰ ਆਪਾਂ ਘੋਂ ਕੋਹਲੂ ਤੁਹਾਡਾ ਆਪਣਾ ਵਾ ਠੀਕ ਹੈ ਸਰ ਠੀ ਹਾਂਜੀ ਹਾਂਜੀ ਸਰ ਸਰ ਤੇਲ ਦਾ ਕੀ ਪ੍ਰਾਈਜ਼ ਆ ਜੀ ਨਹੀਂ ਸਰ ਤੁਸੀਂ ਪੋਮ ਅੱਛਾ ਠੀਕ ਹੈ ਜੀ ਠੀਕ ਹੈ ਸਾਨੂੰ ਸਰ ਪੰਜਾਹ ਲੀਟਰ ਤੇਲ ਚਾਹੀਦਾ ਜੀ ਸ਼ੋਪ ਦੇ ਲਈ ਅਤੇ ਖੁੱਲ੍ਹਾ ਤੇਲ ਮਿਲ ਜੂਗਾ ਸਾਨੂੰ ਨਹੀਂ ਸਰ ਸਾਨੂੰ ਖੁੱਲ੍ਹਾ ਚਾਹੀਦਾ ਆਪਣੀ ਸ਼ੋਪ ਦੇ ਲਈ ਅਤੇ ਅਸੀਂ ਇਹ ਆਪ ਪੈਕਿੰਗ ਕਰਕੇ ਅੱਗੇ ਸੇਲ ਕਰਨਾ ਵਾ ਰੀਸੇਲ 'ਤੇ ਕਰਨਾ ਅਸੀਂ ਠੀਕ ਆ ਸਰ ਅਤੇ ਹੋਰ ਸਰ ਆਪਾਂ ਕੀ ਬਣਾਉਂਦੇ ਹਾਂ ਜੀ ਠੀਕ ਹੈ ਸਰ ਤੁਸੀਂ ਸਰ ਇਸ ਤਰ੍ਹਾਂ ਕਰਿਓ ਸਾਨੂੰ ਪੰਜਾਹ ਕਿਲੋ ਗੁੜ ਤਿਆਰ ਕਰ ਦਿਓ ਸਰ ਅਸੀਂ ਕੱਲ੍ਹ ਨੌਂ ਵਜੇ ਤੁਹਾਡੇ ਕੋਲ ਆ ਰਹੇ ਹਾਂ ਠੀਕ ਆ ਸਰ ਨਾਲੇ ਅਸੀਂ ਚੈੱਕ ਕਰ ਲਵਾਂਗੇ ਜੀ ਤੁਹਾਡੀ ਕੁਆਲਟੀ ਹਾਂਜੀ ਸਰ ਓਕੇ ਸਰ ਸਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਦਿਓ ਸਰ

ਓਕੇ ਸਰ ਅਸੀਂ ਜੜਤੌਲੀ ਪਿੰਡ ਆ ਕੇ ਤੁਹਾਨੂੰ ਕਾਲ ਕਰਾਂਗੇ ਸਰ ਓਕ ਓਕੇ ਓਕੇ ਜੀ ਥੈਂਕ ਯੂ